ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਪ ਜੀ ਨਾਲ ਆਪਣਾ ਪਹਿਲਾਂ ਐਕਸਪੀਰੀਅੰਸ ਹੈਂਡਬੈਗ ਖਰੀਦਣ ਦਾ ਔਨਲਾਈਨ ਪ੍ਰੋਡਕਟ ਖਰੀਦਣ ਦਾ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਹੋਇਆ ਇਸ ਤਰ੍ਹਾਂ ਕਿ ਵੈਸੇ ਤਾਂ ਮੈਂ ਬੈਗ ਜ਼ਿਆਦਾਤਰ ਮਾਰਕੀਟ ਤੋਂ ਹੀ ਜਾ ਕੇ ਖਰੀਦ ਦੀ ਸਾਂ ਮਾਰਕੀਟ ਵਿੱਚ ਬਹੁਤ ਸਾਰੀਆਂ ਕੁਆਲਿਟੀਆਂ ਮਿਲ ਜਾਂਦੀਆਂ ਸਨ ਜਿਹਨਾਂ ਵਿੱਚੋਂ ਬੈਗ ਦੀ ਚੋਣ ਕਰਨਾ ਮੈਨੂੰ ਅਸਾਨ ਲੱਗਦਾ ਸੀ ਮੈਂ ਇਸ ਤਰ੍ਹਾਂ ਇੱਕ ਦਿਨ ਬੈਗ ਖਰੀਦਣ ਗਈ ਤਾਂ ਰਸਤੇ ਵਿੱਚ ਮੈਨੂੰ ਮੇਰੀ ਫਰੈਂਡ ਮਿਲ ਪਈ ਜਦੋਂ ਮੈਂ ਉਸਨੂੰ ਦੱਸਿਆ ਕਿ ਮੈਂ ਬੈਗ ਖਰੀਦਣਾ ਹੈ ਤਾਂ ਉਸ ਨੇ ਮੈਨੂੰ ਕਿਹਾ ਕਿ ਮੈਂ ਤਾਂ ਜ਼ਿਆਦਾਤਰ ਔਨਲਾਈਨ ਇਸ ਪ੍ਰੋਡਕਟ ਤੋਂ ਹੀ ਬੈਗ ਖਰੀਦਦੀ ਹਾਂ ਬੈਗ ਵੀ ਬਹੁਤ ਵਧੀਆ ਹੁੰਦੇ ਹਨ ਅਤੇ ਮੈਂ ਜਦੋਂ ਉਸਨੂੰ ਕਿਹਾ ਕਿ ਆਪਣਾ ਬੈਗ ਮੈਨੂੰ ਦਿਖਾਇਆ ਜਾਵੇ ਤਾਂ ਉਸ ਨੇ ਮੈਨੂੰ ਅਗਲੇ ਦਿਨ ਆਪਣਾ ਉਹ ਬੈਗ ਲਿਆ ਕੇ ਦਿਖਾਇਆ ਜਦੋਂ ਮੈਂ ਬੈਗ ਦੇਖਿਆ ਤਾਂ ਮੈਂ ਬਹੁਤ ਖੁਸ਼ ਹੋਈ ਕਿਉਂਕਿ ਕਲਰ ਤਾਂ ਬਹੁਤ ਵਧੀਆ ਸੀ ਉਸਦੀ ਕੁਆਲਿਟੀ ਵੀ ਬਹੁਤ ਵਧੀਆ ਸੀ ਲੈਦਰ ਬਹੁਤ ਵਧੀਆ ਸੀ ਸਪੇਸ ਵੀ ਕਾਫ਼ੀ ਸੀ ਮੈਂ ਸੋਚਿਆ ਕਿਉਂ ਨਾ ਮੈਂ ਵੀ ਇਹੋ ਜਿਹਾ ਹੀ ਬੈਗ ਹੀ ਮੰਗਾਵਾਵਾਂ ਕਿਉਂਕਿ ਮੈਨੂੰ ਉਹ ਬੈਗ ਬਹੁਤ ਪਸੰਦ ਆਇਆ ਮੈਂ ਜਲਦੀ ਹੀ ਉਹ ਬੈਗ ਮੰਗਵਾਉਣ ਲਈ ਔਡਰ ਕਰ ਦਿੱਤਾ ਕੁਛ ਦਿਨ ਪਏ ਤਾਂ ਮੈਨੂੰ ਦੋ ਤਿੰਨ ਦਿਨਾਂ ਵਿੱਚ ਹੀ ਉਹ ਬੈਗ ਦਾ ਔਡਰ ਆ ਗਿਆ ਜਦੋਂ ਮੈਂ ਖੋਲ੍ਹਿਆ ਬੈਗ ਦੇਖਿਆ ਉਸਦਾ ਰੰਗ ਦੇਖ ਕੇ ਤਾਂ ਮੈਂ ਬਹੁਤ ਹੀ ਖੁਸ਼ ਹੋਈ ਬੈਗ ਖੋਲ੍ਹਿਆ ਬੈਗ ਦੀਆਂ ਜ਼ਿਪ ਖੋਲ੍ਹੀਆਂ ਤਾਂ ਅੰਦਰਲੀ ਸਪੇਸ ਬਹੁਤ ਵਧੀਆ ਸੀ ਬਹੁਤ ਜ਼ਿਆਦਾ ਸੀ ਅੰਦਰ ਜ਼ਿਪਾਂ ਦੋ ਤਿੰਨ ਜਿਪਾਂ ਅੰਦਰ ਸਨ ਦੋ ਬਾਹਰ ਸਨ ਬੈਗ ਦੇ ਹੈਂਡਲ ਬੈਗ ਦੀ ਤਣੀ ਕਿਸੇ ਤਰ੍ਹਾਂ ਵੀ ਮੈਂ ਵੇਅਰ ਕਰ ਸਕਦੀ ਸਾਂ ਇਕੱਲੇ ਹੈਂਡਲ ਫੜ ਕੇ ਵੀ ਤਣੀ ਉਤਾਰ ਕੇ ਵੀ ਮੈਂ ਲੈ ਸਕਦੀ ਸਾਂ ਅਤੇ ਤਣੀ ਪਾ ਕੇ ਮੋਢੇ 'ਤੇ ਲੌਂਗ ਬੈਗ ਵੀ ਕਰ ਸਕਦੀ ਸਾਂ ਜਦੋਂ ਮੈਂ ਅਗਲੇ ਦਿਨ ਉਹ ਬੈਗ ਲੈ ਕੇ ਸਕੂਲ ਪਹੁੰਚੀ ਤਾਂ ਜਦੋਂ ਮੈਨੂੰ ਮੇਰੇ ਨਾਲ ਦੀਆਂ ਫਰੈਂਡ ਨੇ ਉਸ ਬੈਗ ਦੀ ਤਰੀਫ਼ ਕਰਦਿਆਂ ਹੋਇਆ ਪੁੱਛਿਆ ਇਹ ਬੈਗ ਕਿੱਥੋਂ ਲਿਆ ਹੈ ਤਾਂ ਮੈਂ ਜਦੋਂ ਉਹਨਾਂ ਨੂੰ ਦੱਸਿਆ ਕਿ ਮੈਂ ਇਹ ਬੈਗ ਇਸ ਤਰ੍ਹਾਂ ਔਨਲਾਈਨ ਅਪਲਾਏ ਕਰਕੇ ਮੰਗਵਾਇਆ ਹੈ ਤਾਂ ਉਹਨਾਂ ਨੇ ਵੀ ਉਸ ਤਰ੍ਹਾਂ ਇਹ ਬੈਗ ਮੰਗਵਾਉਣਾ ਚਾਹਿਆ ਅਤੇ ਮੈਂ ਜਦੋਂ ਉਹਨਾਂ ਨੂੰ ਉਹ ਅਡਰੈਸ ਦਿੱਤਾ ਤਾਂ ਉਹਨਾਂ ਨੇ ਅਜਿਹਾ ਹੀ ਬੈਗ ਆਪ ਆਪਣੇ ਲਈ ਵੀ ਔਡਰ ਕਰ ਦਿੱਤਾ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿਉਂ ਕਿ ਬੈਗ ਮੇਰਾ ਸਭ ਨੇ ਤਰੀਫ਼ ਕੀਤੀ ਸਭ ਨੇ ਪਸੰਦ ਕੀਤਾ ਸੀ ਅਤੇ ਉਸ ਤਰ੍ਹਾਂ ਦਾ ਹੀ ਬੈਗ ਮੰਗਵਾਉਣਾ ਚਾਹਿਆ ਸੀ ਧੰਨਵਾਦ